ਸਮੇਂ ਦੇ ਨਾਲ ਪੰਜਾਬ ਦੀ ਜਿਹੜੀ ਜਨਸੰਖਿਆ ਏ ਉਹਦੇ ਵਿੱਚ ਕਾਫੀ ਤਬਦੀਲੀ ਆਈ ਹੈਗੀ ਹੈ ਜਿੱਦਾਂ ਹੁਣ ਮੰਨ ਲਓ ਜਿਹੜਾ ਦੇਸ਼ ਦੀ ਜਿਹੜੀ ਮ ਪੂਰਾ ਭਾਰਤ ਹੈਗਾ ਏ ਉਹਦੇ ਵਿੱਚ ਜਿਹੜੀ ਭਾ ਪੰਜਾਬ ਦੀ ਆਬਾਦੀ ਹੈਗੀ ਹੈ ਉਹ ਢਾਈ ਕੁ ਪਰਸੈਂਟ ਹੈਗੀ ਏ ਉਹ ਤੋਂ ਇਲਾਵਾ ਜਿਹੜਾ ਇੱਥੇ ਹੈਗਾ ਪੰਜਾਬ ਦੀ ਸ਼ਹਿਰੀਕਰਨ ਦੇ ਵਿੱਚ ਵੀ ਕਾਫੀ ਬਹੁਤ ਜ਼ਿਆਦਾ ਵਾਧਾ ਹੋਇਆ ਹੈਗਾ ਏ ਕਿਉਂਕਿ ਵਾਧਾ ਤਾਂ ਹੋਇਆ ਹੈ ਕਿਉਂਕਿ ਜਿੱਦਾਂ ਜਿੱਦਾਂ ਇੱਥੇ ਪੰਜਾਬ ਵਿੱਚ ਇੰਡਸਟਰੀਜ ਦਾ ਵਿਕਾਸ ਹੋ ਰਿਹਾ ਹੈਗਾ ਏ ਇੰਡਸਟਰੀਆਂ ਨਵੇਂ ਤੋਂ ਨਵੇਂ ਉਦਯੋਗ ਲੱਗ ਰਹੇ ਹੈਗੇ ਹੈ ਫੈਕਟਰੀਆਂ ਖੁੱਲੀਆਂ ਹੈਗੀਆਂ ਏ ਤਾਂ ਉਹਦਾ ਜਿਹੜਾ ਆਲਾ ਦੁਆਲਾ ਹੈਗਾ ਏ ਉਹ ਸ਼ਹਿਰੀਕਰਨ ਦਾ ਕਾਫੀ ਜ਼ਿਆਦਾ ਵਿਕਾਸ ਹੋ ਰਿਹਾ ਹੈਗਾ ਏ ਜਿੱਦਾਂ ਹੁਣ ਸਾਡਾ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਹੈ ਤਾਂ ਰੋਪੜ ਤੋਂ ਜਿਹੜੇ ਨਵਾਂਸ਼ਹਿਰ ਵੱਲ ਜਿੱਥੇ ਆਪਾਂ ਐਂਟਰ ਕਰਦੇ ਹੈਗੇ ਹੈ ਉੱਥੇ ਜਾ ਕੇ ਪੰ ਅੱਠ ਤੋਂ ਦਸ ਸਾਡਾ ਫੈਕਟਰੀਆਂ ਹੈਗੀਆਂ ਏ ਜਿਹੜੇ ਅੱਠ ਦਸ ਫੈਕਟਰੀਆਂ ਏ ਉਹਦੇ ਨਾਲ ਨਾਲ ਇੱਕ ਮਾਰਕੀਟ ਜਿਹੀ ਕ੍ਰੀਏਟ ਹੋ ਗਈ ਹੈ ਸ਼ਹਿਰੀਕਰਨ ਜਿਹਾ ਹੋ ਗਿਆ ਹੈਗਾ ਇਹ ਜਿਹੜਾ ਉਹ ਏਰੀਆ ਹੈਗਾ ਉੱਥੇ ਦਾ ਕਾਫੀ ਡਿਵੈਲਪ ਹੋ ਗਿਆ ਵਾ ਹੈਗਾ ਏ ਜਿਹੜੇ ਉੱਥੇ ਲੋਕਾਂ ਨੂੰ ਮਤਲਬ ਰੁਜ਼ਗਾਰ ਵੀ ਕਾਫੀ ਮਿਲਿਆ ਹੈਗਾ ਉਹਨਾਂ ਕੋਲ ਮਤਲਬ ਇਕਨੋਮਿਕਲੀ ਕਾਫੀ ਹੋਏ ਹੈਗੇ ਹੈ ਉਹਦੇ ਬਾਅਦ ਜਿਹੜਾ ਪੰਜਾਬ ਦਾ ਹੈਗਾ ਏ ਆਰਥਿਕ ਪੱਧਰ 'ਤੇ ਵੀ ਇਹਦੇ ਨਾਲ ਕਾਫੀ ਉਹਨੂੰ ਮਤਲਬ ਮਦਦ ਮਿਲੀ ਹੈਗੀ ਹੈ ਉਹ ਤੋਂ ਇਲਾਵਾ ਜਿਹੜੇ ਸਾਡੇ ਪੰਜਾਬ ਹੈਗਾ ਏ ਪੰਜਾਬ ਦੇ ਜਿਹੜੇ ਹੈਗੇ ਆ ਯੂਥ ਹੈ ਜਿਹੜਾ ਅੱਜ ਕੱਲ੍ਹ ਦਾ ਉਹ ਕੰਮ ਦੀ ਭਾਲ 'ਚ ਵਿਦੇਸ਼ਾਂ ਵਿੱਚ ਜਾਣਾ ਮਤਲਬ ਜ਼ਿਆਦਾ ਵਧੀਆ ਸਮਝਦਾ ਹੈਗਾ ਵਿਦੇਸ਼ਾਂ ਵੱਲ ਨੂੰ ਜ਼ਿਆਦਾ ਭੱਜ ਰਿਹਾ ਹੈਗਾ ਏ ਉਹ